ਖਰਾਬ ਪ੍ਰੋਜੈਕਟ ਖਰਾਬ ਬਹੁਤ ਵਾਰੀ ਹੋਇਆ ਬਹੁਤ ਵਾਰੀ ਉਧੇੜ ਕੇ ਕਈ ਵਾਰੀ ਸ ਸਟੀਚਿੰਗ ਕਰਦੇ ਟਾਈਮ ਉਧੇੜਿਆ ਕਈ ਵਾਰੀ ਨੀਟਿੰਗ ਕਰਦੇ ਟਾਈਮ ਡਿਜ਼ਾਇਨ ਵਗੈਰਾ ਕਈ ਵਾਰੀ ਨਹੀਂ ਬਣਦਾ ਸਹੀ ਤਾਂ ਬਹੁਤ ਵਾਰੀ ਉਧੇੜ ਉਧੇੜ ਕੇ ਬਣਾਇਆ ਕਈ ਵਾਰੀ ਕੁੰਡੇ ਡਿੱਗ ਗਏ ਥੱਲੇ ਉਹਨੂੰ ਚੱਕਣ ਲਈ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰੀ ਬਹੁਤ ਜ਼ਿਆਦਾ ਨੀਚੇ ਚਲਾ ਜਾਂਦਾ ਏ ਕੁੰਡਾ ਤਾਂ ਫਿਰ ਉਧੇੜਨਾ ਪੈਂਦਾ ਫਿਰ ਬਣਾਉਣਾ ਪੈਂਦਾ ਬਹੁਤ ਵਾਰੀ ਸਟਰਗਲ ਕੀਤਾ ਇੱਦਾਂ ਮੈਂ ਬੁਣ ਬੁਣ ਕੇ ਕਿੰਨੀ ਵਾਰੀ ਉਧੇੜਿਆ ਮਤਲਬ ਤਿੰਨ ਚਾਰ ਵਾਰੀ ਕਈ ਵਾਰੀ ਤਾਂ ਉੱਧੜ ਜਾਂਦਾ ਹੈ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਸਾਰਾ ਸਾਰਾ ਦਿਨ ਹੀ ਲੰਘ ਜਾਂਦਾ ਸਾਰਾ ਸਾਰਾ ਦਿਨ ਹੀ ਨਹੀਂ ਬੁਣਿਆ ਜਾਂਦਾ ਗਾ ਕਈ ਵਾਰੀ ਡਿਜ਼ਾਇਨ ਇੱਦਾਂ ਦਾ ਹੁੰਦਾ ਕਈ ਔਖਾ ਉਹਨੂੰ ਸਰਲ ਟਾਈਪ ਕਰਨ ਲਈ ਫਿਰ ਸੋਚਣਾ ਪੈਂਦਾ ਹੈ ਫਿਰ ਬਣਾਓ ਫਿਰ ਉਧੇੜੋ ਫਿਰ ਬਣਾਓ ਫਿਰ ਉਧੇੜੋ ਕਈ ਵਾਰੀ ਤਿੰਨ ਚਾਰ ਵਾਰੀ ਪੰਜ ਵਾਰੀ ਚਾਰ ਵਾਰੀ ਇੰਨੇ ਵਾਰੀ ਉਧੇੜ ਉਧੇੜ ਉਧੇੜ ਉਧੇੜ ਬਣਾਉਣਾ ਪੈਂਦਾ ਏ ਸਿਲਾਈ ਵਿੱਚ ਵੀ ਕਈ ਵਾਰੀ ਇੱਦਾਂ ਬਹੁਤ ਵਾਰੀ ਹੋਇਆ ਹੈ ਜਿਵੇਂ ਸਿਲਾਈ ਕੀਤੀ ਸੂਟ ਬਣਾਇਆ ਸਟਿਚ ਕੀਤਾ ਨਹੀਂ ਡਿਜ਼ਾਇਨ ਸਹੀ ਬਣਿਆ ਫਿਰ ਉਧੇੜਿਆ ਕਈ ਵਾਰੀ ਪਲੇਟਾਂ ਨਾ ਸਹੀ ਪਈਆਂ ਤਾਂ ਪਲੇਟਾਂ ਉਧੇੜ ਕੇ ਪਾਈਆਂ ਕਈ ਵਾਰੀ ਬਖਾ ਨਹੀਂ ਸਹੀ ਵੱਜਿਆ ਬਖਾ ਉਧੇੜੋ ਬਖਾ ਉਧੇੜ ਕੇ ਸਹੀ ਕੀਤਾ ਏ ਬਹੁਤ ਵਾਰੀ ਐਵੇਂ ਉਧੇੜ ਉਧੇੜ ਭੁਦੇੜ ਕਿੰਨੇ ਵਾਰੀ ਕੀਤੀ ਆ ਉਧੇੜ ਕੇ ਫਿਰ ਉਹਨੂੰ ਸਹੀ ਕਰਕੇ ਫਿਰ ਬਣਾਓ ਕੁੰਡਿਆਂ ਨੂੰ ਸਹੀ ਕਰਕੇ ਪਾਓ ਕੁੰਡੇ ਨਹੀਂ ਕਈ ਵਾਰੀ ਤਾਂ ਸਹੀ ਪੈਂਦੇ ਨੀਟਿੰਗ ਡਿਜ਼ਾਈਨ 'ਚ ਵੀ ਨੀਟਿੰਗ ਡਿਜਾਇਨ 'ਚ ਕਈ ਵਾਰੀ ਆਪਾਂ ਬਾਰਡਰ ਬਣਾਉਂਦੇ ਹਾਂ ਉਹ ਵੀ ਬਾਰਡਰ ਵੀ ਕਈ ਵਾਰੀ ਸਹੀ ਨਹੀਂ ਬਣਦਾ ਗਾ ਫੇਰ ਉਹਨੂੰ ਉਧੇੜ ਕੇ ਬਣਾਓ